ਮੇਰੇ ਲਿਖਣ ਨਾਲ ਸਬੰਧਿਤ ਮਤਲਬ ਇਹ ਏਮ ਹੈ ਮਤਲਬ ਮੋਟੀਵੇਸ਼ਨਲ ਏਮ ਹਨ ਮੇਰੇ ਕਿ ਕਿਸੇ ਨੂੰ ਕਿਸੇ ਵੀ ਚੀਜ਼ ਨਾਲ ਮੋਟੀਵੇਟ ਕਰਨ ਨਾਲ ਸੰਬੰਧਿਤ ਮੇਰੇ ਏਮ ਹਨ ਜਿਹਦੇ ਨਾਲ ਕਿ ਕਿਸੇ ਵੀ ਪਰਸਨ ਨੂੰ ਮੋਟੀਵੇਟ ਕੀਤਾ ਜਾ ਸਕੇ ਕਿਸੇ ਵੀ ਪਰਸਨ ਨੂੰ ਕਿਸੇ ਚੰਗੀ ਚੀਜ਼ ਬਾਰੇ ਕੁੱਝ ਜਾਗਰੂਕ ਕੀਤਾ ਜਾ ਸਕੇ ਅਤੇ ਮੈਂ ਆਪਣੀ ਲਿਖਤ ਨਾਲ ਜੋ ਹੈ ਆਪਣੇ ਆਪਣੀ ਉਮੀਦ ਜੋ ਵੀ ਮੈਨੂੰ ਐਕਸਪੈਕਟੇਸ਼ਨ ਹਨ ਆਪਣੀ ਲਾਈਫ ਤੋਂ ਮੈਂ ਉਹਨਾਂ ਸਭ ਚੀਜ਼ਾਂ ਨੂੰ ਆਪਣੀ ਲਾਈਫ 'ਚ ਮਤਲਬ ਰੀਅਲ ਕਰਨਾ ਚਾਹੁੰਦੀ ਹਾਂ ਦੇਖਣਾ ਚਾਹੁੰਦੀ ਹਾਂ ਅਤੇ ਫੀਲ ਕਰਨਾ ਚਾਹੁੰਦੀ ਹਾਂ ਜਿਸ ਕਰਕੇ ਜੋ ਹੈ ਕਿ ਮਤਲਬ ਕਿਸੇ ਨੂੰ ਵੀ ਇਸ ਚੀਜ਼ ਤੋਂ ਮੋਟੀਵੇਸ਼ਨਲ ਮਿਲੇ ਅਤੇ ਮੈਨੂੰ ਖੁਦ ਨੂੰ ਵੀ ਇਸ ਚੀਜ਼ ਤੋਂ ਮਤਲਬ ਇਹ ਹੋਵੇ ਕਿ ਹਾਂ ਮੈਂ ਆਪਣੀ ਆਉਣ ਵਾਲੇ ਟਾਈਮ ਵਿੱਚ ਜਾਂ ਮੈਂ ਆਪਣੀ ਆਉਣ ਵਾਲੇ ਸਮੇਂ ਵਿੱਚ ਆਪਣੀ ਲਿਖਤ ਦੇ ਨਾਲ ਆਪਣੀ ਲਿਖਣ ਦੇ ਏਮਸ ਜੋ ਵੀ ਮੇਰੇ ਹਨ ਜੋ ਵੀ ਮੇਰੇ ਟੀਚੇ ਹਨ ਜੋ ਵੀ ਮੇਰੀਆਂ ਇੱਛਾਵਾਂ ਹਨ ਜੋ ਵੀ ਮੈਂ ਲਿਖਿਆ ਹੈ ਉਹਦੇ ਨਾਲ ਜੋ ਹੈ ਆਪਣੀ ਲਾਈਫ ਨੂੰ ਮੈਂ ਸਕਸੈੱਸਫੁਲ ਸਫ਼ਲਤਾ ਪ੍ਰਾਪਤ ਕਰ ਸਕਦੀ ਹਾਂ